ਸਾਹ ਰੋਕਣਾ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਕਿ ਲੰਬੇ ਸਮੇਂ ਤੋਂ ਭਾਰਤ ਵਿੱਚ ਚੱਲੀ ਆ ਰਹੀ ਇਹ ਪ੍ਰਕਿਰਿਆ ਸੰਤਾਂ ਫਕੀਰਾਂ ਦੇ ਸਮੇਂ ਭਗਤੀ ਮਾਰਗ ਵਿੱਚ ਚਲਦੀ ਸੀ ਜਿੱਥੇ ਉਹ ਭਗਤੀ ਦੇ ਵਿੱਚ ਬਹਿੰਦੇ ਆਪਣੇ ਸਾਹ ਨੂੰ ਰੋਕ ਲੈਂਦੇ ਸਨ ਅਤੇ ਲਗਾਤਾਰ ਮੈਡੀਟੇਸ਼ਨ ਸਿਮਰਨ ਕਰਦੇ ਰਹਿੰਦੇ ਸਨ ਜਿਸ ਦੇ ਨਾਲ ਉਹਨਾਂ ਦੀ ਇੰਨੀ ਸਾਰੀ ਲੰਬੀ ਉਮਰ ਹੋ ਜਾਂਦੀ ਸੀ ਸਾਹ ਰੋਕਣਾ ਇੱਕ ਅਜਿਹੀ ਤਕਨੀਕ ਹੈ ਜਿਸ ਦੇ ਨਾਲ ਅਸੀਂ ਆਪਣੇ ਸਵਾਸਾਂ ਨੂੰ ਘ ਨੂੰ ਘਟਾਇਆ ਜਾ ਸਕਦਾ ਹੈ ਉਸਦਾ ਕੁਝ ਸਮਾਂ ਸਵਾਸਾਂ ਤਾਂ ਘੱਟ ਕੀਤਾ ਜਾ ਸਕਦਾ ਹੈ ਅਤੇ ਲੰਮੇ ਸਮੇਂ ਤੱਕ ਅਸੀਂ ਜਿਉਂ ਸਕਦੇ ਹਾਂ ਸਾਹ ਰੋਕਣ ਦਾ ਸਭ ਸਾਹ ਰੋਕਣ ਨੂੰ ਨਿਯੰਤਰਣ ਕਰਨਾ ਇੱਕ ਵਧੀਆ ਤਰੀਕਾ ਹੈ ਜਿਵੇਂ ਕਿ ਹੁਣ ਅਸੀਂ ਕਸਰਤ ਕਰਦੇ ਹਾਂ ਤਾਂ ਜਿਸ ਦੇ ਨਾਲ ਸਾਡੇ ਸਵਾਸ ਚਲਦੇ ਰਹਿੰਦੇ ਹਨ ਅਗਰ ਅਸੀਂ ਸਾਹ ਰੋਕ ਕੇ ਮੈਡੀਟੇਸ਼ਨ ਜਾਂ ਕਰਦੇ ਕਸਰਤ ਕਰਦੇ ਹਾਂ ਸਾਡੇ ਜਿਉਣ ਦਾ ਲੰਮਾ ਸਮਾਂ ਟਾਈਮ ਪੀਰੀਅਡ ਵੱਧ ਜਾਂਦਾ ਹੈ